ਅਸੀਂ ਹਰੇਕ ਸਾਲ ਸਕੂਲ ਦੇ ਫੰਕਸ਼ਨ 'ਚ ਹਿੱਸਾ ਲੈਂਦੇ ਤੇ ਫੁੱਲ ਮੈਂ ਕਹਿੰਦਾ ਰੱਜ ਕੇ ਤਿਆਰੀ ਕਰਦੇ ਤੇ ਮੈਡਮ ਦੇ ਮੈਡਮ ਦੇ ਘਰ ਹਿੱਸਾ ਵੀ ਲਿਆ ਦੇਖਿਆ ਵੀ ਆ ਇੱਕ ਮਤਲਬ ਕਿ ਜਦ ਦੇ ਸਕੂਲ 'ਚੋਂ ਪਾਸ ਆਊਟ ਹੋ ਗਏ ਉਹ ਉਹ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਹਰੇਕ ਸਾਲ ਫੰਕਸ਼ਨ ਲੈਂਦੇ ਫੰਕਸ਼ਨ 'ਚ ਹਿੱਸਾ ਲੈਂਦੇ ਤੇ ਅਤੇ ਨੱਚਦੇ ਵੀ ਤੇ ਭੰਗੜੇ ਪਾਉਂਦੇ ਤੇ ਪੂਰੇ ਅਤੇ ਜਿਹੜੇ ਨਾਲ ਦੇ ਬੰਦੇ ਤੇ ਉਹਨਾਂ ਨੂੰ ਸਿਖਾਉ ਸਿਖਾਉਂਦੇ ਵੀ ਤੇ ਅਤੇ ਪਹਿਲਾਂ ਅਸੀਂ ਸਿੱਖਦੇ ਤੇ ਜਦ ਅਸੀਂ ਭੰਗੜਾ ਭੁੰਗੜਾ ਪਾ ਕੇ ਐਨ ਵਧੀਆ ਕਰਦੇ ਤੇ ਫਿਰ ਜਦ ਅਸੀਂ ਪਾਸ ਆਊਟ ਹੋ ਗਏ ਫਿਰ ਨਾਲ ਦੇ ਜਿਹੜੇ ਛੋਟੇ ਸਾਡੇ ਯੂਵਾ ਸਾਡੇ ਤੋਂ ਬਾਅਦ ਆਏ ਫਿਰ ਉਹਨਾਂ ਨੂੰ ਅਸੀਂ ਸਿਖਾਉਂਦੇ ਤੇ ਵੀ ਆਹ ਇੱਦਾਂ ਨਹੀਂ ਐਵੇਂ ਕਰੋ ਆਹ ਗਾਣੇ 'ਤੇ ਇੱਦਾਂ ਸਟੈਪ ਪੰਜਾਬੀ ਲੋਕ ਗੀਤ ਅਤੇ ਐਵੇਂ ਐਵੇਂ ਨਾਟਕ ਕਰਨਾ ਕੋਈ ਕੁੜੀਆਂ ਵੀ ਹੁੰਦੀ ਤੀ ਸਾਡੇ ਨਾਲ ਉਹਨਾਂ ਨੂੰ ਵੀ ਸਿਖਾਇਆ ਫਿਰ ਅਸੀਂ ਨਾਟਕ ਨੂਟਕ ਕਰਨੇ ਉੱਥੇ ਅਤੇ ਸਕਿੱਟਾਂ ਵਗੈਰਾ ਅਤੇ ਕਾਫੀ ਵਧੀਆ ਤਜਰਬਾ ਵੀ ਸਾਡਾ ਬਹੁਤ ਵਧੀਆ ਰਿਹਾ ਤਕਰੀਬਨ ਅਸੀਂ ਓ ਹੁੰਦੇ ਤੇ ਅਤੇ ਇੱਕ ਕੁਲਦੀਪ ਮੈਡਮ ਦੀ ਕੁੜੀ ਹੁੰਦੀ ਤੀ ਅਤੇ ਉਹ ਉਹ ਵੀ ਤਕਰੀਬਨ ਸਾਰਿਆਂ ਨਾਲੋਂ ਵਧੀਆ ਹੀ ਕਰਦੀ ਹਰੇਕ ਪਾਰਟੀਸਪੇਟ 'ਚ ਪ੍ਰੋਗਰਾਮ 'ਚ ਪਾਰਟੀਸਪੇਟ ਕਰਨਾ ਅਤੇ ਅਸੀਂ ਤਕਰੀਬਨ ਦਸ ਕੁ ਮੁੰਡੇ ਜਾਂ ਕੁੜੀਆਂ ਹੁੰਦੇ ਤੇ ਜਿਹੜੇ ਹਰੇਕ ਫੰਕਸ਼ਨ 'ਚ ਹਿੱਸਾ ਲੈਂਦੇ ਤੇ ਅਤੇ ਆਪਣੇ ਵੱਲੋਂ ਵਧੀਆ ਟਰਾਈ ਕੋਸ਼ਿਸ਼ ਹੁੰਦੀ ਤੀ ਕਰਨ ਦੀ ਵੀ ਸਭ ਨਾਲੋਂ ਵਧੀਆ ਕੀਤਾ ਜਾ ਸਕੇ